ਕਿਸਾਨ ਇਹ ਕਿਵੇਂ ਯਕੀਨੀ ਬਣਾ ਸਕਦੇ ਹਨ ਕਿ ਉਹਨਾਂ ਦੇ ਜਾਨਵਰ ਤੰਦਰੁਸਤ ਅਤੇ ਰੋਗਾਂ ਤੋਂ ਮੁਕਤ ਹੋਣ ਜੋ ਮਨੁੱਖਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਹਿੰਟ ਨਿਯਮਤ ਸਿਹਤ ਜਾਂਚ ਟੀਕਾਕਰਨ ਆਦਿ ਕੁਝ ਬਿਮਾਰੀਆਂ ਕੀ ਹਨ ਜੋ ਜਾਨਵਰ ਦੀ ਬੁਰੀ ਤਰ੍ਹਾਂ ਬੇਰਹਿਮੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜਾਨਵਰਾਂ ਦੀ ਕੇਅਰ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਮਤਲਬ ਉਹਨਾਂ ਨੂੰ ਟਾਈਮ 'ਤੇ ਮਤਲਬ ਪਟ ਜਿੱਦਾਂ ਹੁਣ ਸਵੇਰੇ ਆਪਾਂ ਪੱਠੇ ਪਾਉਦੇ ਹਾਂ ਦੁਪਹਿਰੇ ਸੰਨੀ ਕਰੀਦੀ ਆ ਅਤੇ ਸ਼ਾਮ ਨੂੰ ਮਤਲਬ ਉਹਨਾਂ ਨੂੰ ਫਿਰ ਪੱਠੇ ਪਾਈਏ ਆ ਤਾਂ ਮਤਲਬ ਇਹ ਸਾਰਾ ਕੁਛ ਮਤਲਬ ਉਹਨਾਂ ਦੀ ਕੇਅਰ ਨਾਲ ਹੀ ਮਤਲਬ ਸਾਰਾ ਕੁਛ ਹੋ ਸਕਦਾ ਉਹਨਾਂ ਦੇ ਮਤਲਬ ਟੀਕਾ ਵਗੈਰਾ ਟਾਈਮ 'ਤੇ ਲੱਗਦਾ ਲੱਗਣਾ ਚਾਹੀਦਾ ਹੈ ਉਹਦੇ ਨਾਲ ਟੀਕੇ ਦੇ ਨਾਲ ਮਤਲਬ ਬਹੁਤ ਬਿਮਾਰੀਆਂ ਦੂਰ ਹੋ ਜਾਂਦੀਆਂ ਕੁਛ ਮਤਲਬ ਕੀਟਾਣੂ ਵਗੈਰਾ ਵੀ ਉਹਨਾਂ ਦੇ ਨਹੀਂ ਹੁੰਦੇ ਟੀਕਿਆਂ ਨਾਲ ਕਾਫੀ ਬੈਨੀਫਿਟ ਹੁੰਦਾ ਉਹਦੇ ਨਾਲ ਦੁੱਧ ਵਗੈਰਾ ਵੀ ਵਧੀਆ ਦਿੰਦੇ ਆ ਅਤੇ ਇਹਨਾਂ ਨੂੰ ਨਹਿਲਾਣਾ ਵੀ ਸਹੀ ਮਤਲਬ ਟਾਈਮ 'ਤੇ ਨਹਿਲਾਉਣਾ ਪੈਂਦਾ ਸਾਰਾ ਕੁਛ ਮਤਲਬ ਵਧੀਆ ਕਰਨਾ ਪੈਂਦਾ ਇਹਨਾਂ ਦੀ ਮਤਲਬ ਕਾਫ਼ੀ ਕੇਅਰ ਕਰਨੀ ਪੈਂਦੀ ਆ